ਪੰਜਾਬ ਵਿੱਚ ਭਾਰਤ ਦੇ ਦੂਜੇ ਰਾਜਾਂ ਦੇ ਮੁਕਾਬਲੇ ਸਿਹਤ ਦੀ ਗੁਣਵੱਤਾ ਕਿਤੇ ਵਧੇਰੇ ਹੈ ਕਿਉਂਕਿ ਪਹਿਲਾ ਰੀਜਨ ਇਹ ਹੈ ਕਿ ਪੰਜਾਬ ਦੇ ਲੋਕ ਇਤਿਹਾਸ ਤੋਂ ਆਪਾਂ ਆਪਾਂ ਜਾਣੂ ਹੋ ਸਕਦੇ ਹਾਂ ਕਿ ਪ ਪੰਜਾਬ ਦੇ ਲੋਕ ਸ਼ੁਰੂ ਤੋਂ ਹੀ ਬਹੁਤ ਜੁਝਾਰੂ ਰਹੇ ਹਨ ਜੁਝਾਰੂ ਹੋਣ ਤੋਂ ਭਾਵ ਕਿ ਬਹੁਤ ਮਿਹਨਤੀ ਅਤੇ ਉਤਸ਼ਾਹਿਤ ਰਹੇ ਹਨ ਦੂਜਾ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਸਿਹਤ ਨਾਲ ਜੁੜੀਆਂ ਖੇਡਾਂ ਪ੍ਰਚਲਿਤ ਨੇ ਜੋ ਕਿ ਪੰਜਾਬੀ ਨੌਜਵਾਨਾਂ ਨੂੰ ਬਹੁਤ ਹੀ ਪ੍ਰਭਾਵਿਤ ਕਰਦੇ ਨੇ ਜਿਵੇਂ ਮਾਂ ਬੋਲੀ ਖੇਡ ਕਬੱਦ ਕਬੱਡੀ ਸਭ ਤੋਂ ਵੱਡੀ ਉਦਾਹਰਣ ਇਸ ਤੋਂ ਇਲਾਵਾ ਪੰਜਾਬ ਦਾ ਖਾਣ ਪੀਣ ਦੂਜਿਆਂ ਨਾਲੋਂ ਬਹੁਤ ਹੀ ਵਧੇਰੇ ਅਤੇ ਪੌਸ਼ਟਿਕ ਹੈ ਪੰਜਾਬ ਵਿੱਚ ਲਗਭਗ ਇੱਕ ਤਿਹਾਈ ਦੁੱਧ ਦਾ ਜੋ ਖਪਤ ਹੈ ਬਾਕੀ ਰਾਜਾਂ ਨਾਲੋਂ ਬਥੇਰੇ ਵਧੇਰੇ ਆ ਦੁੱਧ ਦੁੱਧ ਤੋਂ ਇਲਾਵਾ ਪੰਜਾਬ ਦੇ ਫਲ ਫਰੂਟ ਅਤੇ ਹੋਰ ਆਹਾਰ ਬਹੁਤ ਹੀ ਪੌਸ਼ਟਿਕ ਹ ਹੁੰਦੇ ਨੇ ਦੂਜੇ ਰਾਜਾਂ ਨਾਲੋਂ ਸੋ ਇਹ ਕੁਛ ਕੁ ਰੀਜ਼ਨ ਹੈਗੇ ਨੇ ਕਿ ਪੰਜਾਬ ਦੂਜੇ ਰਾਜਾਂ ਨਾਲੋਂ ਵਧੇਰੇ ਸਿਹਤ ਵਿੱਚ ਗੁਣਵੱਤਾ ਰੱਖਦਾ